ਪੰਜਾਬੀ ਭਾਸ਼ਾ ਸਾਡੇ ਗੁਰੂਆਂ ਦੁਆਰਾ ਦਿੱਤੀ ਗਈ ਭਾਸ਼ਾ ਹੈ ਇਸ ਦਾ ਵਿਕਾਸ ਬਹੁਤ ਪ੍ਰਾਚੀਨ ਸਮੇਂ ਤੋਂ ਕੀਤਾ ਜਾ ਰਿਹਾ ਹੈ ਸਾਡੇ ਗੁਰੂਆਂ ਨੇ ਲੰਡੇ ਅੱਖਰਾਂ ਤੋਂ ਇਸ ਦਾ ਵਿਕਾਸ ਕੀਤਾ ਫਿਰ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਲਿੱਪੀਬੱਧ ਕੀਤਾ ਤਾਂ ਇਹ ਅੱਜ ਜਿਹੜੀ ਭਾਸ਼ਾ ਹੈਗੀ ਇਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬੋਲੀ ਜਾਂਦੀ ਹੈ ਤਾਂ ਇਸ ਦਾ ਭਾਸ਼ਾ ਦਾ ਜਿਹੜਾ ਮੇਨ ਏਰੀਆ ਹੈ ਉਹ ਪੰਜਾਬ ਰਿਹਾ ਹੈ ਸ਼ੁਰੂ ਤੋਂ ਹੀ ਤਾਂ ਇੱਥੋਂ ਦੇ ਲੋਕ ਨੇ ਉਹ ਪੰਜਾਬੀ ਭਾਸ਼ਾ ਹੀ ਬੋਲਦੇ ਹਨ ਅਤੇ ਪੰਜਾਬੀ ਭਾਸ਼ਾ ਨੂੰ ਹੀ ਸਮਝਦੇ ਹਨ ਪਰ ਅੱਜ ਜਿਹੜਾ ਸਮਾਂ ਹੈ ਉਹ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਗੰਭੀਰਤਾ ਰੱਖ ਰਿਹਾ ਹੈ ਲੋਕ ਅੰਗਰੇਜ਼ੀ ਭਾਸ਼ਾ ਪ੍ਰਤੀ ਬਹੁਤ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ ਜੋ ਕਿ ਬਹੁਤ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਜਿਹੜੀ ਭਾਸ਼ਾ ਹੁੰਦੀ ਹੈ ਉਹ ਕਿਸੇ ਰਾਜ ਦੇ ਲਈ ਬਹੁਤ ਵੱਡੀ ਦੇਣ ਹੁੰਦੀ ਹੈ ਉਸ ਨੂੰ ਬਚਾ ਕੇ ਰੱਖਣਾ ਉਸ ਦ ਉਸ ਰਾਜ ਦੇ ਉਸ ਦੇਸ਼ ਦੇ ਨਾਗਰਿਕਾਂ ਦਾ ਕਰਤੱਵ ਹੁੰਦਾ ਹੈ ਪਰ ਸਾਡੇ ਲੋਕ ਪੰਜਾਬੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗਾ ਹੈ ਅਸੀਂ ਇਹ ਨਹੀਂ ਆਖਦੇ ਵੀ ਇੰ ਇੰਗਲਿਸ਼ ਲੈਂਗੁਏਜ ਮਾੜੀ ਹੈ ਨਹੀਂ ਇੰਗਲਿਸ਼ ਲੈਂਗੁਏਜ ਬਹੁਤ ਚੰਗੀ ਹੈ ਬਹੁਤ ਉਸਦਾ ਸਕੋਪ ਹੈ ਪਰ ਕੀ ਆਪਣੀ ਭਾਸ਼ਾ ਨੂੰ ਭੁੱਲ ਜਾਣਾ ਸਹੀ ਗੱਲ ਹੈ ਨਹੀਂ ਤਾਂ ਸਾਨੂੰ ਆਪਣੀ ਭਾਸ਼ਾ ਨੂੰ ਨੂੰ ਸਹੀ ਤਰੀਕੇ ਦੇ ਨਾਲ ਬੋਲਣਾ ਅਤੇ ਉਸਦੇ ਵਿਕਾਸ ਬਾਰੇ ਗੱਲ ਕਰਨੀ ਚਾਹੀਦੀ ਹੈ ਸਾਨੂੰ ਅੱਜ ਇਸ ਮੰਚ ਉੱਤੇ ਇਕੱਠੇ ਹੋ ਕੇ ਬੈਠਣਾ ਚਾਹੀਦਾ ਹੈ ਅਤੇ ਸਾਡੀ ਭਾਸ਼ਾ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਇਹ ਕਿਵੇਂ ਸੁਰੱਖਿਅਤ ਹੋ ਸਕਦੀ ਹੈ ਜੇਕਰ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰ ਦਿੰਦੇ ਹਾਂ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਸਬੰਧੀ ਵੱਖ ਵੱਖ ਤਰ੍ਹਾਂ ਦੇ ਡਿਬੇਟ ਕਰਵਾਏ ਜਾਂਦੇ ਹਨ ਨਾਟਕ ਕਰਵਾਏ ਜਾਂਦੇ ਹਨ ਅਤੇ ਪੰਜਾਬੀ ਨਾਲ ਸੰਬੰਧਿਤ ਕਹਾਣੀਆਂ ਕਹਾਣੀਆਂ ਲੇਖ ਲਿਖਣ ਦੇ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਸਾਨੂੰ ਇਹ ਗੱਲਾਂ ਦੇ ਨਾਲ ਹੀ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਉਹ ਅੱਗੇ ਵਧ ਸਕਦੀ ਹੈ ਅਤੇ ਜਿਹੜੀ ਭਾਸ਼ਾ ਹੈ ਬਹੁਤ ਵਧੀਆ ਭਾਸ਼ਾ ਹੈ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਹੈ